ਹੈਲੋ ਹੈਲੋ ਹਾਂਜੀ ਨਮਸਤੇ ਨਮਸਤੇ ਮੈਮ ਹਾਂਜੀ ਹਾਂਜੀ ਮੈਮ ਮੈਂ ਨਾ ਤੁਹਾਡੇ ਨਾ ਸਕੂਲ ਬਾਰੇ ਗੱਲ ਕਰਨੀ ਸੀ ਕਲਾਸ ਦੇ ਮੈਂ ਨਿਊ ਜੁਆਏ ਕੀਤਾ ਅਤੇ ਮੈਨੂੰ ਕਲਾਸ 'ਚ ਨਾ ਬਹੁਤ ਪ੍ਰੋਬਲਮ ਆ ਰਹੀ ਹੋਈ ਹੈ ਹਾਂਜੀ ਅਤੇ ਕੁਛ ਥੋੜ੍ਹਾ ਬਲੈਕ ਬੋਰਡ ਕਰਕੇ ਹੈ ਕਿ ਉੱਥੇ ਪ੍ਰੋਪਰ ਰੋਸ਼ਨੀ ਨਹੀਂ ਆ ਰਹੀ ਅਤੇ ਮੈਨੂੰ ਲਿਖਣ 'ਚ ਬਹੁਤ ਪ੍ਰੋਬਲਮ ਹੁੰਦੀ ਹੈ ਕੁਛ ਸਟੂਡੈਂਟ ਇੱਦਾਂ ਪਿੱਛੇ ਬੈਠੇ ਹੁੰਦੇ ਹੈ ਉਹਨਾਂ ਨੂੰ ਦਿਖਾਈ ਨਹੀਂ ਦਿੰਦਾ ਠੀਕ ਸੇ ਅਤੇ ਉਹ ਜਿਹੜੇ ਸਟੂਡੈਂਟ ਇੱਦਾਂ ਦੇ ਹੈ ਕਿ ਕਹਿਣੇ 'ਚ ਨਹੀਂ ਹੈਗੇ ਉਹਨੂੰ ਪੂਰਾ ਹੋਮਵਰਕ ਦਿੰਨੇ ਹਾਂ ਪਰ ਉਹ ਟੈਮ ਸਿਰ ਕਰਕੇ ਨਹੀਂ ਆ ਰਹੇ ਹੈਗੇ ਹਾਂਜੀ ਹਾਂਜੀ ਹੋਰ ਮੈਂ ਕਹਿਣਾ ਚਾਹੁੰਦੀ ਹਾਂ ਕਿ ਬਸ ਇੱਕ ਕਲਾਸ 'ਚ ਸਾਫ਼ ਸਫ਼ਾਈ ਵੱਲ ਖਿਆਲ ਰੱਖਿਆ ਜਾਏ ਅਤੇ ਪ੍ਰੋਪਰ ਸਾਫ਼ ਸਫ਼ਾਈ ਨਹੀਂ ਇੰਨੀ ਹੋ ਰਹੀ ਹੈਗੀ ਹਾਂਜੀ ਹੋਰ ਕੁਛ ਨਹੀਂ ਜਿੱਦਾਂ ਚੇਅਰਸ ਹੈ ਚੇਅਰਸ ਚੇਅਰਸ ਵੀ ਥੋੜ੍ਹੀ ਨਾ ਲੂਜ ਹੈ ਹਿਲਦੀ ਹੈ ਬੈਠੋ ਤਾਂ ਥੋੜ੍ਹਾ ਟੇਬਲ ਵੀ ਠੀਕ ਕਰਵਾਉਣ ਵਾਲਾ ਹੈ ਇੱਥੇ ਹਾਂਜੀ ਹਾਂਜੀ ਹਾਂਜੀ ਬਾਕੀ ਬਾਕੀ ਠੀਕ ਹੈ ਬੱਚੇ ਬਹੁਤ ਵਧੀਆ ਤਰੀਕੇ ਨਾਲ ਪੜ੍ਹ ਰਹੇ ਹੈ ਅਤੇ ਕੁਛ ਦੋ ਚਾਰ ਬੱਚੇ ਇੱਦਾਂ ਦੇ ਹੈ ਕਿ ਜਿਹੜਾ ਆਪਣਾ ਰੈਗੂਲਰ ਕੰਮ ਨਹੀਂ ਕਰਕੇ ਆ ਰਹੇ ਠੀਕ ਤਰ੍ਹਾਂ ਹਾਂਜੀ ਨਾ ਹੀ ਉਹ ਕਹਿਣਾ ਮੰਨ ਰਹੇ ਹੈ

ਠੀਕ ਹੈ ਮੈਮ ਓਕੇ ਓਕੇ